ਸਤਿ ਸ਼੍ਰੀ ਅਕਾਲ ਬਾਈ ਜੀ ਗਗਨ ਬੋਲਦਾ ਵੀਰਾ ਵੀਰੇ ਜਿਹੜਾ ਮੈਂ ਫੋਨ ਤੁਹਾਡੇ ਕੋਲ਼ੋਂ ਔਡਰ ਕੀਤਾ ਸੀਗਾ ਉਹ ਬੰਦਾ ਦੇ ਕੇ ਗਿਆ ਸੀਗਾ ਤੁਹਾਡਾ ਯਾਰ ਬੰਦੇ ਨੂੰ ਗੱਲ ਕਰਨੇ ਦਾ ਨਹੀਂ ਪਤਾ ਜਮ੍ਹਾ ਯਾਰ ਮਾੜਾ ਮੋਟਾ ਸਮਝਾਉ ਉਹਨੂੰ ਬੰਦੇ ਨੂੰ ਵੀ ਕਿੱਦਾਂ ਡੀਲ ਕਰੀ ਦੀ ਕਿਸੇ ਨਾਲ਼ ਹਾਂਜੀ ਫੋਨ ਵੀਰੇ ਫੋਨ ਵਿੱਚ ਵੀ ਦਿੱਕਤਾਂ ਕਾਫੀ ਆ ਗਈਆਂ ਇੱਕ ਤਾਂ ਡੱਬਾ ਨਹੀਂ ਸੀਗਾ ਠੀਕ ਉਹਦਾ ਫੋਨ ਦਾ ਜਦੋਂ ਡਿਲੀਵਰ ਕਰਨ ਆਇਆ ਬੰਦਾ ਮੈਂ ਤਾਂ ਦੇਖ ਕੇ ਹੀ ਹੈਰਾਨ ਹੋ ਗਿਆ ਬਈ ਫੋਨ ਦੀ ਹਾਲਤ ਕਿਆ ਕਰੀ ਪਈ ਆ ਵੀ ਇਹਦਾ ਕੈਮਰਾ ਨਹੀਂ ਵੀਰ ਸੈੱਟ ਹੈਗਾ ਸਕਰੈਚ ਪਏ ਪਏ ਡਿਸਪਲੇਅ 'ਤੇ ਵੀ ਸਕਰੈਚ ਹੈ ਬੈਕ 'ਤੇ ਵੀ ਸਕਰੈਚ ਹੈ ਬੜਾ ਔਖਾ ਹੋ ਜਾਂਦਾ ਯਾਰ ਵੀਰ ਐਦਾਂ ਫਿਰ ਤੁਹਾਨੂੰ ਪਤਾ ਬੰਦੇ ਨੇ ਐਨੇ ਪੈਸੇ ਵੀ ਲਾਉਣੇ ਫਿਰ ਵੀ ਗੱਲ ਜਿਹੀ ਬਣੇ ਨਾ ਫੇਰ ਸਵਾਦ ਜਿਹਾ ਨਹੀਂ ਆਉਂਦਾ ਨਹੀਂ ਨਹੀਂ ਵੀਰੇ ਉਹਦਾ ਤਾਂ ਕੋਈ ਚੱਕਰ ਨਹੀਂ ਯਾਰ ਸੋਰੀ ਇਹ ਤਾਂ ਕੋਈ ਗੱਲ ਨਹੀਂ ਬਾਈ ਪਰ ਗੱਲ ਬਣੀ ਨਹੀਂ ਵੀਰ ਫੋਨ ਵਾਲ਼ੀ ਮੈਂ ਫੋਨ ਵਾਪਸ ਕਰੂੰਗਾ ਵੀਰ ਨਹੀਂ ਵੀਰ ਉਹਦਾ ਕੈਮਰਾ ਵੀ ਠੀਕ ਨਹੀਂ ਨਾ ਆਵਾਜ਼ ਵੀ ਬੜੀ ਘੱਟ ਆ ਰਹੀ ਮੈਂ ਅਜੇ ਕੱਲ੍ਹ ਕਹਿਣ ਤਾਂ ਵੀ ਚਲ ਇੱਕ ਦੋ ਦਿਨ ਯੂਜ ਕਰਕੇ ਦੇਖ ਲੈਦੇ ਹਾਂ ਜੇ ਤਾਂ ਸੈਟਿੰਗ ਹੋ ਗਈ ਠੀਕ ਹੈ ਪਰ ਵੀਰ ਐਨੇ ਪੈਸੇ ਲਾ ਕੇ ਫਾਇਦਾ ਨਹੀਂ ਹੈਗਾ ਕੋਈ ਫੋਨ ਮੈਨੂੰ ਵਾਪਸੇ ਕਰਨਾ ਪੈਣਾ ਤੁਸੀਂ ਬਾਈ ਬਣ ਕੇ ਮੇਰੇ ਮੈਂ ਆਵਾਂਗਾ ਜੀ ਥੋੜ੍ਹੇ ਦਿਨਾਂ ਦੇ ਵਿੱਚ ਫੋਨ ਤੁਸੀਂ ਆਪਣਾ ਵਾਪਸ ਲੈ ਲਿਓ ਮਤਲਬ ਠੀਕ ਨਹੀਂ ਲੱਗਿਆ ਜੀ ਕਿਸੇ ਹੋਰ ਕੰਪਨੀ ਦਾ ਦੇਖ ਲਵਾਂਗੇ ਜੀ ਨਵਾਂ ਪਰ ਆਹ ਫੋਨ ਨਹੀ ਲੈਣਾ ਜੀ ਹੈਗਾ ਹਾਂਜੀ ਫਿਰ ਬਾਈ ਬਣ ਕੇ ਤੁਸੀਂ ਵਾਪਸ ਕਰ ਲਿਓ ਜੀ ਇਹ ਆਪਾਂ ਕੋਈ ਹੋਰ ਦੇਖ ਲਵਾਂਗੇ ਜੀ